ਪੂਰੇ ਸਥਾਨ 'ਤੇ ਘੜਿਆਂ ਜਾਂ ਬੋਤਲ ਬੰਦ ਪਾਣੀ ਨਾਲ ਕਈ ਵਾਰ ਵਾਟਰ ਸਟੇਸ਼ਨ ਸਥਾਪਿਤ ਕਰੋ ਇਹ ਯਕੀਨੀ ਬਣਾਉਂਦਾ ਹੈ ਕਿ ਮਹਿਮਾਨ ਪੂਰੇ ਪ੍ਰੋਗਰਾਮ ਦੌਰਾਨ ਆਸਾਨੀ ਨਾਲ ਪਾਣੀ ਤੱਕ ਪਹੁੰਚ ਸਕਣ ਬੋਤਲ ਬੰਦ ਪਾਣੀ ਪ੍ਰਦਾਨ ਕ ਪ੍ਰਦਾਨ ਕਰਨ 'ਤੇ ਵਿਚਾਰ ਕਰੋ ਖਾਸ ਕਰਕੇ ਜੇਕਰ ਪ੍ਰੋਗਰਾਮ ਬਾਹਰ ਹੈ ਜਾਂ ਅਜਿਹੀ ਜਗ੍ਹਾ 'ਤੇ ਜਿੱਥੇ ਸਾਫ ਪਾਣੀ ਦੀ ਪਹੁੰਚ ਸੀਮਿਤ ਹੋ ਸਕਦੀ ਹੈ ਤੁਸੀਂ ਵਧੇਰੇ ਵਿਅਕਤੀਗਤ ਅਹਿਸਾਸ ਲਈ ਬਰਾਂਡਡ ਜਾਂ ਵਾਤਾਵਰਣ ਸਾਨੂੰ ਹੋਰ ਵਿਕਲਪ ਪੇਸ਼ ਕਰ ਸਕਦੇ ਹੋ ਵਾਟਰ ਕੂਲਰ ਜਾਂ ਡਿਸਪਲੇ ਡਿਸਪੈਂਸਰ ਕਿਰਾਏ 'ਤੇ ਲੈਣਾ ਇੱਕ ਵਾਤਾਵਰਨ ਨੂੰ ਅਨੁਕੂਲ ਅਤੇ ਲਾਗਤ ਪ੍ਰਭਾਵਸ਼ਾਲੀ ਹੋ ਹੱਲ ਹੋ ਸਕਦਾ ਹੈ ਖਾਸ ਕਰਕੇ ਜੇਕਰ ਤੁਸੀਂ ਮੁੜ ਵਰਤੋਂ ਯੋਗ ਭਾਰਤ ਕਰ